ਯੋਗਾ ਸ਼ੁਰੂ ਕਰਨ ਦੀ ਜਿਹੜੀ ਉਹ ਸਹੀ ਉਮਰ ਹੈ ਉਹ ਕਹਿ ਸਕਦੇ ਹਾਂ ਆਪਾਂ ਵੀ ਪੰਜ ਸਾਲ ਤੋਂ ਬਾਅਦ ਅਸੀਂ ਯੋਗਾ ਸ਼ੁਰੂ ਕਰ ਸਕਦੇ ਹਾਂ ਛੋਟੀ ਉਮਰ 'ਚ ਯੋਗਾ ਕਰਨ ਦੇ ਕੀ ਫਾਇਦੇ ਹੈ ਜੇ ਅਸੀਂ ਇਸ ਗੱਲ 'ਤੇ ਵਿਚਾਰ ਕਰੀਏ ਤਾਂ ਛੋਟੀ ਉਮਰ ਦੇ ਵਿੱਚ ਸਾਡਾ ਜਿਹੜਾ ਸਰੀਰ ਹੈ ਉਹ ਬੜਾ ਮਤਲਬ ਜਲਦੀ ਮੂਵ ਕਰ ਸਕਦਾ ਅਸੀਂ ਜਲਦੀ ਸਿੱਖ ਸਕਦੇ ਹਾਂ ਅਸੀਂ ਜਲਦੀ ਉਹ ਸਾਰੇ ਜਿਹੜੇ ਯੋਗਾ ਦੇ ਵਿੱਚ ਸਟੈਪ ਹੈਗੇ ਆ ਉਹ ਅਸੀਂ ਕਰ ਸਕਦੇ ਹੈਗੇ ਹਾਂ ਅਤੇ ਯੋਗਾ ਕਰਨ ਦੇ ਨਾਲ ਸਾਡੀ ਸਿਹਤ ਹੈ ਜਿਹੜੀ ਉਹ ਬਹੁਤ ਹੀ ਫਾਇਦਾ ਉਹਦਾ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸਾਨੂੰ ਜਿਹੜੀਆਂ ਐਲੋਪੈਥਿਕ ਮੈਡੀਸਨ ਅੰਗਰੇਜ਼ੀ ਦਵਾਈਆਂ ਅਸੀ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਜੇ ਅਸੀਂ ਯੋਗਾ ਨਹੀਂ ਕਰਦੇ ਤਾਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਸਾਨੂੰ ਐਲੋਪੈਥਿਕ ਡੋਕਟਰਾਂ ਕੋਲ ਜਾਣਾ ਪੈਂਦਾ ਜਿਹੜੇ ਸਾਨੂੰ ਬਹੁਤ ਵੱਡੀ ਮਾਤਰਾ 'ਚ ਸਟੀਰਾਈਡ ਵਗੈਰਾ ਦਿੰਦੇ ਆ ਜਾਂ ਮੈਡੀਸਨ ਦਿੰਦੇ ਜਿਹਦੇ ਸਾਈਡ ਇਫੈਕਟਸ ਬਹੁਤ ਹੁੰਦੇ ਹੈ ਅਸੀਂ ਸਿਰ ਦਰਦ ਦੀ ਗੋਲੀ ਲੈਂਦੇ ਹਾਂ ਤਾਂ ਉਹਦਾ ਗੁਰਦੇ 'ਤੇ ਅਸਰ ਪੈਂਦਾ ਹਾਰਟ 'ਤੇ ਅਸ ਅਸਰ ਪੈਂਦਾ ਅੱਖਾਂ 'ਤੇ ਅਸਰ ਪੈਂਦਾ ਹੋਰ ਬਹੁਤ ਸਾਰੇ ਬੈਡ ਇਫੈਕਟਸ ਹੁੰਦੇ ਆ ਅਤੇ ਜਿਹਦੇ ਕਰਕੇ ਸਾਨੂੰ ਸਮੱਸਿਆਵਾਂ ਆਉਂਦੀਆਂ ਪਰ ਜੇ ਅਸੀਂ ਛੋਟੀ ਉਮਰ 'ਚ ਹੀ ਯੋਗਾ ਸ਼ੁਰੂ ਕਰਨਾ ਸਿੱਖ ਮਤਲਬ ਕਰ ਦਈਏ ਯੋਗਾ ਸਿੱਖਣਾ ਸ਼ੁਰੂ ਕਰ ਦਈਏ ਅਤੇ ਯੋਗਾ ਕਰਨਾ ਸ਼ੁਰੂ ਕਰ ਦਈਏ ਤਾਂ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਬਿਲਕੁਲ ਚੇਂਜ ਹੋ ਸਕਦਾ ਸਾਨੂੰ ਕਿਸੇ ਦਵਾਈ ਦੀ ਜਲਦੀ ਲੋੜ ਨਹੀਂ ਪਏਗੀ ਸਾਡਾ ਸਰੀਰ ਹੈ ਜਿਹੜਾ ਸਾਡੀ ਜਿਹੜੀ ਇਮਿਊਨਟੀ ਹੈ ਉਹ ਸਟਰੋਂਗ ਹੋਏਗੀ ਸਾਡਾ ਸਰੀਰ ਸਟਰੋਂਗ ਹੋਏਗਾ ਜੇ ਸਾਡਾ ਸਰੀਰ ਸਟਰੋਂਗ ਹੋਏਗਾ ਸਾਡੀ ਇਮਊਨਿਟੀ ਸਟਰੋਂਗ ਹੋਏਗੀ ਤਾਂ ਅਸੀਂ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਜਿਉਂ ਸਕਦੇ ਹੈਗੇ ਹਾਂ ਅਤੇ ਛੋਟੀ ਉਮਰ 'ਚ ਯੋਗਾ ਕਰਨ ਦੇ ਇਹ ਬਹੁਤ ਵੱਡੇ ਫਾਇਦੇ ਹੈਗੇ